ਭੰਗੜਾ ਸਾਡੇ ਪੰਜਾਬ ਦੀ ਬਹੁਤ ਹੀ ਲੰਬੀ ਹਿਸਟਰੀ ਤੋਂ ਚੱਲਦਾ ਆ ਰਿਹਾ ਹੈ ਇਹ ਸਾਡੀ ਸੰਸਕ੍ਰਿਤੀ ਨੂੰ ਦਰਸਾਉਂਦਾ ਹੈ ਪੁਰਾਣੇ ਸਮੇਂ ਵਿੱਚ ਲੋਕ ਵਿਆਹਾਂ ਸ਼ਾਦੀਆਂ 'ਤੇ ਜਾਂ ਵੈਸੇ ਹੀ ਘਰਾਂ ਵਿਚ ਜਦੋਂ ਕੋਈ ਤਿਉਹਾਰ ਮਨਾਉਂਦੇ ਸੀ ਤਾਂ ਉਸਦੀ ਖੁਸ਼ੀ ਭੰਗੜਾ ਅਤੇ ਗਿੱਧੇ ਨਾਲ ਦਰਸਾਉਂਦੇ ਸੀ ਹੁਣ ਵੀ ਕਈ ਅਕੈਡਮੀਆਂ 'ਚ ਸਕੂਲਾਂ ਕਾਲਜਾਂ 'ਚ ਭੰਗੜਾ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ ਤਾਂ ਕਿ ਇਹ ਸੰਸਕ੍ਰਿਤੀ ਸਾਡੀ ਅੱਗੇ ਤੋਂ ਅੱਗੇ ਪੀੜ੍ਹੀਆਂ ਤੱਕ ਬਣੀ ਰਹੇ ਭੰਗੜਾ ਐਰੋਬਿਕਸ ਪੰਜਾਬ ਦੇ ਸੱਭਿਆਚਾਰਕ ਵਿਰਸੇ ਨੂੰ ਹੋਰ ਵੱਧ ਕੇ ਦਰਸਾਉਂਦਾ ਹੈ ਕਿਉਂਕਿ ਇਸਦੇ ਵਰਤੋਂ ਨਾਲ ਹਰ ਰੇ ਜਿਵੇਂ ਕਿ ਆਪਾਂ ਉਦਾਹਰਣ ਲੈਂਦੇ ਹਾਂ ਕੋਈ ਵੀ ਐਕਟਰ ਅਗਰ ਐਰੋਬਿਕਸ ਵਿੱਚ ਭੰਗੜਾ ਕਰਦਾ ਹੈ ਆਪਣੇ ਸਰੀਰ ਨੂੰ ਲਚਕਦਾਰ ਬਣਾਉਂਦਾ ਹੈ ਤਾਂ ਉਹ ਉਸਦੀ ਵੀਡੀਓ ਬਣਾ ਕੇ ਕੋਨੇ ਕੋਨੇ ਤੱਕ ਦੇਸ਼ ਦੇ ਕੋਨੇ ਕੋਨੇ ਤੱਕ ਪਹੁੰਚਾਉਂਦਾ ਹੈ ਜਿਸ ਨਾਲ ਭੰਗੜੇ ਦੀ ਹੋਰ ਤੋਂ ਹੋਰ ਪੋਪਲੈਰਟੀ ਹੁੰਦੀ ਹੈ ਪ੍ਰਸਿੱਧਤਾ ਹੁੰਦੀ ਹੈ ਅਤੇ ਲੋਕ ਇਸਨੂੰ ਇਸਤੇਮਾਲ ਆਪਣੇ ਐਕਸਰਸਾਈਜ ਕਰਨ ਵਿੱਚ ਕਰਦੇ ਹਨ ਇਹ ਅ ਅੱਜ ਕੱਲ੍ਹ ਦੇ ਸਮੇਂ 'ਚ ਇਹ ਦੇਸ਼ ਪ੍ਰਦੇਸ਼ ਵਿੱਚ ਸਭ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਦੇ ਵਿਰਸੇ ਵਿੱਚ ਭੰਗੜਾ ਇੱਕ ਬਹੁਤ ਹੀ ਅਲੌਕਿਕ ਸਥਾਨ ਪ੍ਰਦਾਨ ਨਿਭਾਉਂਦਾ ਹੈ